ਪੇਂਡੂ ਖੇਤਰਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਜੋ ਆਪਣਾ ਜੀਵਨ ਸਾਥੀ ਪ੍ਰਾਪਤ ਕਰਨ ਲਈ ਭਾਵ ਅਤੇ ਵਿਆਹ ਕਰਵਾਉਣ ਲਈ ਕਾਫੀ ਦਿੱਕਤਾਂ ਆਉਂਦੀਆਂ ਹਨ ਕਿਉਂਕਿ ਸ਼ਹਿਰੀ ਵਸੋਂ ਵਧਣ ਕਰਕੇ ਜਾਂ ਸ਼ਹਿਰ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਹੋਣ ਕਰਕੇ ਜੋ ਲੋਕ ਹੈ ਪਿੰਡਾਂ ਦੇ ਲੋਕਾਂ ਨੂੰ ਘੱਟ ਪੜ੍ਹਿਆ ਲਿਖਿਆ ਸਮਝਦੇ ਹਨ ਅਤੇ ਸਮਝਦੇ ਹਨ ਕਿ ਪਿੰਡਾਂ ਦੇ ਲੋਕ ਘੱਟ ਪੜ੍ਹੇ ਲਿਖੇ ਹਨ ਪਿੰਡਾਂ ਵਿੱਚ ਅਸੀਂ ਜੋ ਆਪਣਾ ਜੀਵਨ ਹੈ ਉਹ ਵਧੀਆ ਢੰਗ ਨਾਲ ਨਹੀਂ ਬਤੀਤ ਕਰ ਸਕਦੇ ਅਤੇ ਜੋ ਲੋਕ ਹੈ ਉਹ ਪਿੰਡਾਂ ਵੱਲ ਦਾ ਰੁਝਾਨ ਘੱਟ ਕਰਕੇ ਸ਼ਹਿਰਾਂ ਵੱਲ ਵੱਧ ਵੱਧਦੇ ਜਾ ਰਹੇ ਹਨ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਜੋ ਪਿੰਡਾਂ ਦੇ ਨੌਜਵਾਨ ਹਨ ਉਹਨਾਂ ਪ੍ਰਤੀ ਇਹ ਗਲਤ ਰਵੱਈਆ ਨਾ ਰੱਖਣ ਕਿਉਂਕਿ ਪਿੰਡਾਂ ਦੇ ਲੋਕ ਵੀ ਕਾਫੀ ਵੱਡੇ ਪੱਧਰ 'ਤੇ ਤਰੱਕੀਆਂ ਕਰ ਰਹੇ ਹਨ ਜੇ ਲੋਕ ਹੈ ਸ਼ਹਿਰਾਂ ਵਿੱਚ ਵਸਣਾ ਇਸ ਲਈ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਸ਼ਹਿਰ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਜੋ ਦੇਖਦੇ ਹਨ ਕਿ ਆਪਾਂ ਲੋਕਾਂ ਨੂੰ ਮਿਲਦੀਆਂ ਹਨ ਪਿੰਡਾਂ ਵਿੱਚ ਵੀ ਹੁਣ ਕਾਫੀ ਵੱਡੇ ਪੱਧਰ 'ਤੇ ਜੋ ਬਦਲਾਅ ਹੈ ਆ ਚੁੱਕਿਆ ਹੈ ਪਿੰਡਾਂ ਦੇ ਲੋਕ ਵੀ ਵੱਡੇ ਵੱਡੇ ਪੱਧਰ 'ਤੇ ਵੱਡੇ ਵੱਡੇ ਅਫਸਰ ਲੱਗਦੇ ਹਨ ਅਤੇ ਜੋ ਵੱਡੀਆਂ ਵੱਡੀਆਂ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਚੁੱਕੇ ਹਨ ਸੋ ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਮਾੜਾ ਨਾ ਸਮਝਣ ਇਹਨਾਂ ਪ੍ਰਤੀ ਵਧੀਆ ਰਵੱਈਆ ਰੱਖਣ